ਹਾਂ ਮੈਂ ਰੇਲ ਗੱਡੀ ਦਾ ਵਰਣਨ ਕਰ ਸਕਦੀ ਹਾਂ ਰੇਲ ਗੱਡੀ ਵਿੱਚ ਫਸਟ ਕਲਾਸ ਸਭ ਤੋਂ ਜ਼ਿਆਦਾ ਵਧੀਆ ਹੁੰਦੀ ਹੈ ਉਸ ਵਿੱਚ ਏ ਏ ਸੀ ਲੱਗਿਆ ਹੁੰਦਾ ਹੈ ਵਧੀਆ ਸੀਟਾਂ ਹੁੰਦੀਆਂ ਅਤੇ ਪੂਰੀ ਸਫ਼ਾਈ ਵੀ ਹੁੰਦੀ ਹੈ ਉਸ ਤੋਂ ਬਾਅਦ ਆਉਂਦੀ ਹੈ ਸੈਕਿੰਡ ਕਲਾਸ ਸੈਕਿੰਡ ਕਲਾਸ ਦੀ ਸੀਟਾਂ ਵੀ ਵਧੀਆ ਹੁੰਦੀ ਹੈ ਅਤੇ ਫ਼ਿਰ ਜਨਰਲ ਡੱਬੇ ਬਾਕੀ ਸਾਰੇ ਉਹਦੇ 'ਚ ਜਨਰਲ ਡੱਬੇ ਹੀ ਹੁੰਦੇ ਹਨ ਜਨਰਲ ਡੱਬੇ ਵਿੱਚ ਕਾਫ਼ੀ ਸਾਰੀ ਸੀਟਾਂ ਹੁੰਦੀਆਂ ਹਨ ਪਰ ਥੋੜ੍ਹੀ ਛੋਟੀਆਂ ਹੁੰਦੀਆਂ ਹਨ ਉਸ ਵਿੱਚ ਸਲੀਪਰ ਵੀ ਹੁੰਦੇ ਹਨ ਜੇ ਕਿਸੇ ਨੇ ਜ਼ਿਆਦਾ ਲੰਬਾ ਸਫ਼ਰ ਕਰਨਾ ਹੋਵੇ ਜਿੱਦਾਂ ਇੱਕ ਦੋ ਦਿਨ ਦਾ ਹੋਵੇ ਤਾਂ ਸਲੀਪਰ ਵਿੱਚ ਉਹ ਜ਼ਿਆਦਾਤਰ ਸੋ ਵੀ ਸਕਦਾ ਹੈ ਆਰਾਮ ਨਾਲ ਜਿੱਦਾਂ ਮਰਜ਼ੀ ਉੱਠ ਬੈਠ ਸਕਦਾ ਹੈ ਅਤੇ ਉਸ ਦਾ ਇੰਜਣ ਰੇਲ ਗੱਡੀ ਦਾ ਇੰਜਣ ਸਾ ਅੱਗੇ ਹੀ ਲੱਗਿਆ ਹੁੰਦਾ ਹੈ ਰੇਲ ਗੱਡੀ ਦਾ ਇੰਜਣ ਵੈਸੇ ਤਾਂ ਅੱਗੇ ਯਾ ਪਿੱਛੇ ਮਤਲਬ ਦੋਨੋਂ ਜਗ੍ਹਾਂ ਹੀ ਹੁੰਦਾ ਹੈ ਬਟ ਇੱਕ ਟਾਈਮ 'ਚ ਇੱਕ ਹੀ ਚਲਾਇਆ ਜਾਂਦਾ ਹੈ ਜਿਹੜਾ ਜਿੱਧਰ ਨੂੰ ਜਾਣਾ ਹੁੰਦਾ ਹੈ ਉਸ ਤੋਂ ਅੱਗੇ ਵਾਲਾ ਅਤੇ ਸ਼ੇ ਰੇਲ ਗੱਡੀ ਵਿੱਚ ਬਹੁਤ ਸ਼ੋਰ ਵੀ ਹੁੰਦਾ ਹੈ ਬਟ ਉਸ ਜਿਵੇਂ ਕਿ ਜੇ ਜਦ ਰੇਲ ਗੱਡੀ ਸਟਾਰਟ ਹੁੰਦੀ ਹੈ ਤਾਂ ਕੂੰ ਕੂੰ ਦੀ ਆਵਾਜ਼ ਕਰ ਕੇ ਉਹ ਸਟਾਰਟ ਹੁੰਦੀ ਹੈ ਅਤੇ ਜਦੋਂ ਚੱਲਦੀ ਹੈ ਤਾਂ ਛੁੱਕ ਛੁੱਕ ਛੁੱਕ ਦੀ ਆਵਾਜ਼ ਕਰ ਕੇ ਉਹ ਚੱਲਦੀ ਹੈ ਉਸਦੀ ਆਵਾਜ਼ ਬਹੁਤ ਮੈਨੂੰ ਬਹੁਤ ਅੱਛੀ ਲੱਗਦੀ ਹੈ ਰੇਲ ਗੱਡੀ ਦੇ ਪਹੀਏ ਰੇਲ ਗੱਡੀ ਦੇ ਬਹੁਤ ਬਹੁਤ ਵੱਡੇ ਪਹੀਏ ਹੁੰਦੇ ਹਨ ਉਹਦੇ ਵਿੱਚ ਬਹੁਤ ਸਾਰੇ ਪਹੀਏ ਹੁੰਦੇ ਹਨ ਅਤੇ ਰੇਲ ਗੱਡੀ ਦਾ ਟਰੈਕ ਸਿੱਧਾ ਹੀ ਟਰੈਕ ਹੁੰਦਾ ਹੈ ਜਦ ਪੱਟੜੀ ਬਦਲਣੀ ਹੁੰਦੀ ਹਨ ਤਾਂ ਟਰੈਕ ਇੱਕ ਦੂਜੇ ਦੇ ਉੱਪਰੋਂ ਹੋ ਕੇ ਜਾਂਦੇ ਹਨ ਰੇਲ ਗੱਡੀ ਦੀ ਹਾਂ ਮੈਂ ਰੇਲ ਗੱਡੀ ਦੀ ਯਾਤਰਾ ਕੀਤੀ ਹੈ ਅਤੇ ਉਹ ਯਾਤਰਾ ਮੇਰੀ ਬਹੁਤ ਯਾਦਗਾਰ ਯਾਤਰਾ ਸੀ ਉਸ ਟਾਈਮ ਮੈਂ ਆਪਣੇ ਸਕੂਲ ਨਾਲ ਸ਼ਿਮਲੇ ਘੁੰਮਣ ਗਈ ਸੀ ਅਸੀਂ ਸਾਰੇ ਰੇਲ ਗੱਡੀ ਵਿੱਚ ਹੀ ਗਏ ਸੀ ਗੀਤ ਗਾਉਂਦੇ ਵਜਾਉਂਦੇ ਅਤੇ ਬਹੁਤ ਸਾਰੀ ਮੌਜ਼ ਮਸਤੀ ਕਰਦੇ ਹੋਏ ਅਸੀਂ ਉਹ ਰੇਲ ਗੱਡੀ ਦੀ ਯਾਤਰਾ ਪੂਰੀ ਕੀਤੀ ਸੀ